ਜੀ ਮੈਂ ਨਾ ਇੱਕ ਆਡਰ ਕੀਤਾ ਸੀ ਮੇਕਅੱਪ ਕਿੱਟ ਅਤੇ ਉਹ ਨਾ ਮੇਰੇ ਫੇਸ 'ਤੇ ਰੀਐਕਟ ਹੋ ਗਈ ਅਤੇ ਮੈਨੂੰ ਬਿਲਕੁਲ ਨਹੀਂ ਅੱਛਾ ਲੱਗਿਆ ਉਹ ਪ੍ਰੋਡਕਟ ਅਤੇ ਉਹ ਕੰਪਨੀ ਮੈਨੂੰ ਇੰਨੀ ਬਕਵਾਸ ਲੱਗੀ ਮੇਰੇ ਫੇਸ 'ਤੇ ਦਾਣੇ ਦਾਣੇ ਹੋ ਗਏ ਅਤੇ ਮੈਂ ਮੈਂ ਉਹਦੇ ਨਾਲ ਇੱਕ ਲਿਪਸਟਿੱਕ ਵੀ ਆਰਡਰ ਕੀਤੀ ਤੀ ਕੀਤੀ ਸੀ ਅਤੇ ਉਹ ਵੀ ਹਾਫ਼ ਫਿੱਲਡ ਮੈਨੂੰ ਉਹ ਪ੍ਰੋਡਕਟ ਬਹੁਤ ਜ਼ਿਆਦਾ ਬਕਵਾਸ ਲੱਗਿਆ ਮੈਨੂੰ ਏਦਾਂ ਲੱਗਿਆ ਕਿ ਇਹ ਯੂਜਡ ਕੀਤਾ ਹੋਇਆ ਹੈ ਅਤੇ ਮੈਂ ਜਿਸ ਸਾਈਟ ਤੋਂ ਆਡਰ ਕੀਤਾ ਸੀ ਉਹਦੀ ਸਰਵਿਸ ਵੀ ਬੇਕਾਰ ਮੈਨੂੰ ਉਹ ਆਡਰ ਜਾ ਕੇ ਕਿਤੇ ਮੈਂ ਆਡਰ ਕੀਤਾ ਸੀ ਚਾਰ ਇੱਕ ਹਫ਼ਤੇ ਪਹਿਲਾਂ ਅਤੇ ਮੈਨੂੰ ਮਿਲਿਆ ਉਹ ਪ੍ਰੋਡਕਟ ਅੱਜ ਜਾ ਕੇ ਅਤੇ ਜਦੋਂ ਮੈਂ ਅਪਲਾਈ ਕੀਤਾ ਅਤੇ ਮੈਨੂੰ ਰੀਐਕਟ ਕਰ ਗਿਆ ਮੈਨੂੰ ਬਹੁਤ ਬੁਰਾ ਲੱਗਿਆ ਕਿ ਇਹ ਮੈਂ ਸੋਚਿਆ ਸੀ ਅਤੇ ਚਾਰਜਿਸ ਵੀ ਕਾਫ਼ੀ ਜ਼ਿਆਦਾ ਮੈਂ ਸੋਚਿਆ ਸੀ ਚਾਰਜਿਸ ਜ਼ਿਆਦਾ ਤਾਂ ਸਮਾਨ ਮੈਨੂੰ ਚੰਗਾ ਮਿਲੂਗਾ ਬਟ ਸਮਾਨ ਮੈਨੂੰ ਬਿਲਕੁਲ ਨਹੀਂ ਅੱਛਾ ਮਿਲਿਆ ਪ੍ਰੋਡਕਟ ਬਿਲਕੁਲ ਬਕਵਾਸ ਨੇ ਅਤੇ ਮੈਨੂੰ ਇਸ ਇੱਦਾਂ ਲੱਗਦਾ ਕਿ ਕਿਸੇ ਹੋਰ ਨੂੰ ਨਾ ਇਹ ਸਾਈਟ ਤੋਂ ਆਰਡਰ ਹੀ ਨਹੀਂ ਕਰਨਾ ਚਾਹੀਦਾ ਜੀ ਮੈਂ ਹੋਰ ਕੀ ਕਵਾਗੀ ਕਿ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਸਾਈਟ ਦੇ ਰਿਹਾ ਉਹ ਸਾਈਟ ਸਹੀ ਹੈ ਜਾਂ ਇਹ ਕੰਪਨੀ ਖਰਾਬ ਹੈ